ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਦਾਸਪੁਰ ਤੋਂ ਬੋਲਦੀ ਹਾਂ ਮੇਰਾ ਨਾਮ ਰਜਨੀ ਹੈ ਅਤੇ ਮੇਰੇ ਮਾਤਾ ਜੀ ਜਿਹੜੇ ਹੈਗੇ ਆ ਉਹ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਅਤੇ ਮੈਂ ਮਤਲਬ ਉਹਨਾਂ ਨੂੰ ਮਤਲਬ ਅੱਗੇ ਵੀ ਔਨਲਾਈਨ ਮੈਡੀਸਨ ਮੰਗਵਾਈ ਸੀ ਉਹਨਾਂ ਨੇ ਮੈਡੀਸਨ ਮਤਲਬ ਪੂਰੀ ਟਾਈਮ 'ਤੇ ਸਾਨੂੰ ਡਲੀਵਰ ਹੋ ਗਈ ਸੀ ਅਤੇ ਇਸ ਵਾਰ ਵੀ ਮੈਂ ਉਹਨਾਂ ਦੀ ਮੈਡੀਸਨ ਜਿਹੜੀ ਹੈ ਔਨਲਾਈਨ ਹੀ ਮੰਗਵਾਈ ਹੈਗੀ ਹੈ ਉਹਨਾਂ ਦੀ ਮੈਡੀਸਨ ਜਿਹੜੀ ਹੈਗੀ ਆ ਉਹਨਾਂ ਦੀ ਮੈਡੀਸਨ ਦਾ ਨਾਮ ਹੈ ਗਲਾਈਮੇਡ ਮਤਲਬ ਉਹ ਸ਼ੂਗਰ ਦੀ ਹੈਗੀ ਆ ਅਤੇ ਮਤਲਬ ਜਦੋਂ ਮੈਂ ਮੈਡੀਸਨ ਉਹਨਾਂ ਦੀ ਮਤਲਬ ਮੰਗਵਾਈ ਸੀਗੀ ਅਤੇ ਉਹਨਾਂ ਦੇ ਦੋ ਦਿਨ ਦੀ ਮੈਡੀਸਨ ਰਹਿ ਗਈ ਸੀ ਅਤੇ ਮੈਂ ਔਨਲਾਈਨ ਚੈੱਕ ਕੀਤਾ ਸੀ ਅਤੇ ਉਹ ਹਫਤੇ ਦੀ ਮਤਲਬ ਹਫਤੇ ਵਿੱਚ ਹੀ ਉਹ ਡਲੀਵਰੀ ਕਰ ਦਿੰਦੇ ਸੀ ਅਤੇ ਇਸ ਵਾਰ ਮੈਂ ਸੋਚਿਆ ਸ਼ਾਇਦ ਟਾਇਮ 'ਤੇ ਮਿਲੇਗੀ ਲੇਕਿਨ ਉਹਨਾਂ ਨੇ ਮੈਨੂੰ ਅਜੇ ਵੀ ਟਾਈਮ ਟਾਈਮ 'ਤੇ ਨਹੀਂ ਹਾਂਜੀ ਟਾਈਮ 'ਤੇ ਨਹੀਂ ਪਹੁੰਚੀ ਅਜੇ ਤੱਕ ਵੀ ਅਤੇ ਮੈਂ ਮਤਲਬ ਉੱਥੋਂ ਚੈੱਕ ਕੀਤਾ ਅਤੇ ਔਨਲਾਈਨ ਸਾਡਾ ਔਡਰ ਕਿੱਥੇ ਪਹੁੰਚਿਆ ਹੈਗਾ ਤਾਂ ਉਹ ਜਿਹੜੀ ਮੈਡੀਸਨ ਹੈਗੀ ਆ ਅਜੇ ਜਲੰਧਰ ਹੀ ਪਹੁੰਚੀ ਹੈਗੀ ਹੈ ਅਤੇ ਹਾਂਜੀ ਅਜੇ ਮਤਲਬ ਸਾਡੇ ਲੋਕਲ ਏਰੀਏ ਦੇ ਸਾਡੇ ਲੋਕਲ ਏਰੀਏ ਸਿਟੀ ਦੇ ਨਹੀਂ ਪਹੁੰਚੀ ਅਤੇ ਹੁਣ ਜਿਵੇਂ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਜਿਹੜੀ ਮੈਡੀਸਨ ਆ ਉਹ ਸਾਨੂੰ ਟਾਈਮ 'ਤੇ ਘਰ ਪਹੁੰਚਾਈ ਜਾਵੇ ਤਾਂ ਕਿ ਜੇ ਮੇਰੀ ਮ ਮੈਡੀਸਨ ਜੋ ਹੈ ਮੈਂ ਆਪਣੀ ਮਤਲਬ ਮਾਤਾ ਜੀ ਨੂੰ ਟਾਈਮ 'ਤੇ ਦੇ ਸਕਾਂ ਹਾਂਜੀ ਸਰ ਉਹ ਤੁਸੀਂ ਜਿਹੜੀ ਮੈਡੀਸਨ ਹੈ ਸਾਡੀ ਟਾਈਮ ਨਾਲ ਸਾਡੇ ਘਰ ਪਹੁੰਚਾ ਦਿਆ ਕਰੋ ਅਸੀਂ ਅੱਗੇ ਵੀ ਦੁਬਾਰਾ ਔਡਰ ਦਿੰਦੇ ਹੈ ਅਸੀਂ ਇਸ ਕਰਕੇ ਦੁਬਾਰਾ ਔਡਰ ਤਾਂ ਹੀ ਤੁਹਾਨੂੰ ਦੇਵਾਂਗੇ ਜੇ ਸਾਡੀ ਮੈਡੀਸਨ ਜਿਹੜੀ ਹੈ ਟਾਈਮ 'ਤੇ ਪਹੁੰਚੇਗੀ ਹਾਂਜੀ ਸਰ ਇਹਦੇ ਨਾਲ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਸਮਾਨ ਮੰਗਵਾਉਂਦੇ ਹਾਂ ਮੈਡੀਸਨ ਦੇ ਇਲਾਵਾ ਸਾਨੂੰ ਹਰ ਟਾਈਮ ਜਿਹੜੀ ਮੈਡੀਸਨ ਹੈਗੀ ਆ ਟਾਈਮ ਨਾਲ ਸਾਨੂੰ ਘਰ ਮਿਲ ਜਾਂਦੀ ਹੈ ਅਤੇ ਇਸ ਵਾਰ ਪਤਾ ਨਹੀਂ ਫਸਟ ਟਾਇਮ ਜਿਹੜੀ ਸਾਡੀ ਜਿਹੜੀ ਮੈਡੀਸਨ ਹੈਗੀ ਆ ਉਹ ਮਤਲਬ ਲੇਟ ਹੋ ਗਈ ਹੈ ਕਿਉਂਕਿ ਸਾਨੂੰ ਇਸ ਮੈਡੀਸਨ ਦੀ ਬਹੁਤ ਹੀ ਐਮਰਜੰਸੀ ਹੈ ਸਾਡੇ ਮਾਤਾ ਜਿਹੜੇ ਹੈਗੇ ਆ ਉਹ ਜਿਹੜੀ ਮੈਡੀਸਨ ਜੋ ਹੈ ਰੂਟੀਨ ਨਾਲ ਲੈਂਦੇ ਹੈਗੇ ਆ ਥੈਂਕ ਯੂ ਸਰ